ਔਨਲਾਈਨ ਸ਼ਾਪਿੰਗ ਨੇ ਬਾਜ਼ਾਰ ਦੀ ਮ ਮੌਜੂਦ ਸਥਿਤੀ ਨੂੰ ਬਹੁਤ ਜ਼ਿਆਦਾ ਬਦਲ ਦਿੱਤਾ ਹੈ ਇਸ ਦੇ ਬਹੁਤ ਸਾਰੇ ਫਾਇਦੇ ਅਤੇ ਕੁਝ ਨੁਕਸਾਨ ਵੀ ਹਨ ਕੁਝ ਚੰਗੀਆਂ ਚੀਜ਼ਾਂ ਜੋ ਕਿ ਔਨਲਾਈਨ ਸ਼ਾਪਿੰਗ ਦੀਆਂ ਹਨ ਇਹ ਸਾਨੂੰ ਬਹੁਤ ਜ਼ਿਆਦਾ ਸੁਵਿਧਾ ਪ੍ਰੋਵਾਈਡ ਕਰਦੀ ਆ ਔਨਲਾਈਨ ਸ਼ੋਪਿੰਗ ਚੌਵੀ ਘੰਟੇ ਉਪਲਬਧ ਹੈ ਜਿਸ ਨਾਲ ਕਿਸੇ ਵੀ ਸਮੇਂ 'ਤੇ ਖਰੀਦਦਾਰੀ ਕਰਨੀ ਆਸਾਨ ਹੈ ਲੋਕ ਆਪਣੇ ਘਰ ਬੈਠ ਕੇ ਸਾਰੇ ਸਮਾਨ ਮੰਗਵਾ ਸਕਦੇ ਹਨ ਜੋ ਕਿ ਬਹੁਤ ਜ਼ਿਆਦਾ ਵੱਡੀ ਸੁਵਿਧਾ ਹੈ ਜੋ ਕਿ ਅੱਜ ਕੱਲ੍ਹ ਦੇ ਸਮੇਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਨਲਾਈਨ ਸ਼ੌਪਿੰਗ ਵਿੱਚ ਸਾਡੇ ਲਈ ਆਪਸ਼ਨ ਵੱਧ ਹੁੰਦੀਆਂ ਹਨ ਔਨਲਾਈਨ ਪਲੇਟਫਾਰਮ ਵਿੱਚ ਅਨੇਕ ਉਤਪਾਦ ਅਤੇ ਬ੍ਰੈਂਡ ਉਪਲਬਧ ਹੁੰਦੇ ਹਨ ਜਿਹਨਾਂ ਵਿੱਚੋਂ ਚੋਣ ਕਰਨ ਦਾ ਵਿਸ਼ਾਲ ਸਮਰੂਹ ਹੁੰਦਾ ਹੈ ਕੀਮਤ ਤੁਲਨਾ ਜਿਹਨੂੰ ਆਪਾਂ ਔਨਲਾਈਨ ਲੋਕ ਵੱਖ ਵੱਖ ਵੈਬਸਾਈਟਾਂ ਅਤੇ ਪਲੇਟਫਾਰਮਾਂ ਉੱਤੇ ਕੀਮਤਾਂ ਦੀ ਤੁਲਨਾ ਕਰ ਸਕਦੇ ਹਨ ਸਭ ਤੋਂ ਵਧੀਆ ਡੀਲ ਪ੍ਰਾਪਤ ਕਰਦੇ ਹਨ ਜਿਸ ਨਾਲ ਸਾਨੂੰ ਅੱਡ ਅੱਡ ਤਰ੍ਹਾਂ ਦੇ ਡਿਸਕਾਊਂਟ ਕੂਪਣ ਵਗੈਰਾ ਸਾਨੂੰ ਮਿਲਦੇ ਹਨ ਇੱਥੇ ਈਜ਼ੀਲੀ ਡਿਲੀਵਰੀ ਹੁੰਦੀ ਹੈ ਆਰਡਰ ਕਿਤੋਂ ਪਾ ਦਿਓ ਸਿੱਧੇ ਘਰ ਦੇ ਦਰਵਾਜੇ ਅਤੇ ਡਿਲੀਵਰੀ ਕੀਤੇ ਜਾਂਦੇ ਹਨ ਜਿਸ ਨਾਲ ਬਹੁਤ ਸਾਰੀ ਮ ਮਹਨਤ ਬਚਦੀ ਆ ਜਿਸ ਨਾਲ ਬਹੁਤ ਜਿਆਦਾ ਮਿਹਨਤ ਬਚਦੀ ਹੈ ਪੇਮੈਂਟ ਵੀ ਦੀ ਗੱਲ ਜੋ ਔਨਲਾਈਨ ਸ਼ੌਪਿੰਗ ਦੀ ਸਭ ਤੋਂ ਜ਼ਿਆਦਾ ਐਡਵਾਂਟੇਜ ਹੈ ਪੇਮੈਂਟ ਅਸੀਂ ਪੇਮੈਂਟ ਡਿਜੀਟਲ ਕੈਸ਼ ਕੈਸ਼ ਔਨ ਡਿਲੀਵਰੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੁਆਰਾ ਕਰ ਸਕਦੇ ਹਾਂ ਜਿੱਥੇ ਕਈ ਚੀਜ਼ਾਂ ਦੀ ਐਡਵਾਂਟੇਜ ਹੁੰਦੀ ਹੈ ਉੱਥੇ ਡਿਸਅਡਵਾਂਟੇਜ ਵੀ ਹੁੰਦੀ ਹੈ ਉਤਪਾਦ ਅ ਪ੍ਰੋਡਕਟੀ ਪ੍ਰੋਡਕਟ ਕੁਆਲਿਟੀ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਕਈ ਸਮਾਨ ਡਿਫੈਕਟਿਵ ਹੁੰਦੇ ਆ ਜਿਸ ਕਰਕੇ ਉਹਨਾਂ ਦੀ ਕੁਆਲਿਟੀ ਬਹੁਤ ਕਈ ਵਾਰ ਖ਼ਰਾਬ ਨਿਕਲਦੀ ਹੈ ਰਿਟਰਨ ਪੋਲਸੀ ਹਾਲਾਂਕਿ ਬਹੁਤ ਸਾਰੇ ਪਲੇਟਫਾਰਮਾਂ ਵਾ ਫਾਰਮਾਂ ਵਾਪਸੀ ਦੀ ਸਹੂਲਤਾਂ ਕੀਤੀ ਜਾਂਦੀ ਹੈ ਪਰ ਵਾਪਸੀ ਦੀ ਪ੍ਰਕਿਰਿਆ ਕੁਝ ਜ਼ਿਆਦਾ ਲੰਬੇ ਸਮੇਂ ਤੱਕ ਹੁੰਦੀ ਹੈ ਡਿਲੀਵਰੀ ਟਾਈਮ ਕੁਝ ਮਾਮਲੇ ਵਿੱਚ ਡਿਲੀਵਰੀ ਸਮਾਂ ਬਹੁਤ ਲੰਬਾ ਹੁੰਦਾ ਅਤੇ ਤੁਰੰਤ ਜ਼ਰੂਰਤ ਵਾਲੇ ਉਤਪਾਦ ਲਈ ਇਹ ਬਹੁਤ ਹੀ ਜ਼ਿਆਦਾ ਕਠਿਨ ਹੁੰਦਾ ਜੇ ਕਿਸੇ ਨੂੰ ਐਟ ਏ ਟਾਈਮ 'ਤੇ ਲੋੜ ਪੈਂਦੀ ਹੈ ਤਾਂ ਕਈ ਵਾਰ ਔਨਲਾਈਨ ਸ਼ੋਪਿੰਗ 'ਤੇ ਪੰਜ ਛੇ ਦਿਨ ਵੀ ਲੱਗ ਜਾਂਦੇ ਹਨ ਡਿਲੀਵਰੀ ਹੋਣ 'ਤੇ ਅਤੇ ਕੁਝ ਔਨਲਾਈਨ ਸ਼ੋਪਿੰਗ ਪਲੈਟਫਾਰਮ ਜੋ ਇੰਡੀਆ ਵਿੱਚ ਹਨ ਜਿਵੇਂ ਕਿ ਐਮਾਜੋਨ ਜੋ ਕਿ ਬਹੁਤ ਜ਼ਿਆਦਾ ਅੱਜ ਕੱਲ੍ਹ ਵੱਧ ਰਿਹਾ ਫਲਿਪਕਾਰਟ ਮੰਤਰਾ ਸਨੈਪਡੀਲ ਮੀਸ਼ੋ ਇਹ ਬਹੁਤ ਜ਼ਿਆਦਾ ਔਨਲਾਈਨ ਖਰੀਦਦਾਰੀ ਲਈ ਐਪਾਂ ਬਹੁਤ ਜ਼ਿਆਦਾ ਵਰਤੋਂ ਵਿੱਚ ਕੀਤੀਆਂ ਜਾਂਦੀਆਂ ਹਨ